ਸਰਕਾਰ ਵੱਲੋਂ ਸਾਨੂੰ ਕਈ ਤਰ੍ਹਾਂ ਦੀਆਂ ਯੋਜਨਾਵਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਥਰੂ ਸਾਨੂੰ ਬਹੁਤ ਸਾਰੇ ਲਾਭ ਹੁੰਦੇ ਹੈ ਜਿਵੇਂ ਕਿ ਪਿੰਡਾਂ ਵਿੱਚ ਹਰ ਇੱਕ ਘਰ ਦੇ ਮੈਂਬਰਾਂ ਦਾ ਨੀਲਾ ਕਾਰਡ ਬਣਿਆ ਹੁੰਦਾ ਹੈ ਜਿੱਥੋਂ ਸਾਨੂੰ ਫ੍ਰੀ ਕਣਕ ਮਿਲਦੀ ਹੈ ਹੈ ਨਾ ਦੋ ਰੁਪਏ ਦੇ ਹਿਸਾਬ ਨਾਲ ਕਣਕ ਮਿਲਦੀ ਹੈ ਸਾਨੂੰ ਕਈ ਵਾਰੀ ਤਾਂ ਫ੍ਰੀ ਵੀ ਮਿਲਦੀ ਹੈ ਗ ਗਰੀਬ ਪਰਿਵਾਰਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਬਹੁਤ ਲਾਭ ਹੁੰਦਾ ਹੈ ਅਤੇ ਹੋਰ ਵੀ ਜੇ ਆਯੂਸ਼ਮਾਨ ਕਾਰਡ ਹੈ ਉਹਨਾਂ ਦਾ ਪੰਜ ਲੱਖ ਦਾ ਇਲਾ ਇਲਾਜ ਜਿਹੜਾ ਆ ਫ੍ਰੀ ਹੁੰਦਾ ਹੈ ਹੈ ਨਾ ਅਤੇ ਜਿਹੜਾ ਗਰੀਬ ਘਰ ਦੇ ਲੋਕ ਨਹੀਂ ਕਰਵਾ ਪਾਉਂਦੇ ਆਪਣਾ ਇਲਾਜ ਉਹ ਉਸ ਕਾਰਡ 'ਤੇ ਆਪਣਾ ਇਲਾਜ ਕਰਵਾ ਸਕਦੇ ਹੈ ਜਿਨ੍ਹਾਂ ਨਾਲ ਉਹਨਾਂ ਦਾ ਬਹੁਤ ਫਾਇਦਾ ਹੁੰਦਾ ਹੈ ਅਤੇ ਹੋਰ ਵੀ ਜਿਵੇਂ ਬੇਟੀ ਬਚਾਓ ਬੇਟੀ ਪੜਾਓ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਨੇ ਸਰਕਾਰ ਵੱਲੋਂ ਅਤੇ ਜਿਹੜੀਆਂ ਸਕੂਲ ਦੀਆਂ ਬੱਚੀਆਂ ਨੇ ਉਹਨਾਂ ਨੂੰ ਅੱਠਵੀਂ ਤੱਕ ਤਾਂ ਫ੍ਰੀ ਪੜ੍ਹਾਈ ਦਿੱਤੀ ਜਾਂਦੀ ਹੈ ਅਤੇ ਜਦੋਂ ਅੱਗੇ ਨੌਵੀਂ ਤੋਂ ਪਲੱਸ ਟੂ ਕਰਦੀਆਂ ਨੇ ਉਹਨਾਂ ਦੀ ਬਹੁਤ ਘੱਟ ਫੀਸ ਰੱਖੀ ਜਾਂਦੀ ਹੈ ਕੁੜੀਆਂ ਦੀ ਪਰ ਉਹਨਾਂ ਨੂੰ ਜਿਹੜੀਆਂ ਕਿਤਾਬਾਂ ਕਤੂਬਾਂ ਉਹ ਸਕੂਲ ਵੱਲੋਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਅਤੇ ਜਿਹੜੀ ਵਰਦੀਆਂ ਹੁੰਦੀਆਂ ਨੇ ਉਹ ਅੱਠਵੀਂ ਤੱਕ ਤਾਂ ਖਰੀਦ ਦਿੱਤੀਆਂ ਜਾਂਦੀਆਂ ਨੇ ਬੂਟ ਕੋਟੀਆਂ ਸਾਰਾ ਕੁਛ ਪਰ ਜਦੋਂ ਵੱਡੀ ਕਲਾਸਾਂ 'ਚ ਨੌਵੀਂ ਤੋਂ ਪਲੱਸ ਟੂ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਆਪਣੀਆਂ ਲੈਣੀਆਂ ਪੈਂਦੀਆਂ ਨੇ ਹੋਰ ਵੀ ਇੱਦਾਂ ਦੀਆਂ ਕਈ ਸਕੀਮਾਂ ਸਰਕਾਰ ਸਰਕਾਰ ਵੱਲੋਂ ਕੱਢੀਆਂ ਗਈਆਂ ਨੇ ਜਿਨ੍ਹਾਂ ਦਾ ਗਰੀਬ ਪਰਿਵਾਰਾਂ ਨੂੰ ਬਹੁਤ ਲਾਭ ਹੁੰਦਾ ਹੈ